ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਡਮ ਹਾਂਜੀ ਮੈਡਮ ਜੀ ਇੱਥੇ ਪਠਾਨਕੋਟ ਵਿੱਚ ਨਾ ਦੀ ਹਿਮਾਲਿਆ ਬੇਕਰੀ ਆ ਤੇ ਬੜੀ ਚੰਗੀ ਹੈ ਮਲ ਕਿ ਹਰ ਚੀਜ਼ ਚੰਗੀ ਮਿਲ ਜਾਂਦੀ ਹੈ ਬਿਸਕਿਟ ਵਗੈਰਾ ਨਮਕੀਨ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਸਭ ਕੁਛ ਠੀਕ ਠਾਕ ਮਿਲ ਜਾਂਦਾ ਮੈਡਮ ਜੀ ਖੁੱਲ੍ਹਦੀ ਹੈ ਕੋਈ ਨੌਂ ਕੁ ਵਜੇ ਨਾਲ ਅਤੇ ਰਾਤ ਨੂੰ ਦਸ ਗਿਆਰਾਂ ਵਜੇ ਨਾਲ ਬੰਦ ਹੋ ਜਾਂਦੀ ਹੈ ਹਾਂ ਹਾਂਜੀ ਹਾਂਜੀ ਮੈਡਮ ਜੀ ਬਿਲਕੁਲ ਫਰੈਸ਼ ਮਿਲਦਾ ਤੁਸੀਂ ਇੱਕ ਵਾਰੀ ਖਾ ਕੇ ਦੇਖੋਗੇ ਤੁਹਾਨੂੰ ਠੀਕ ਲੱਗੇਗਾ ਤੇ ਫਿਰ ਲੈ ਜਾਈਓ ਠੀਕ ਠੀਕ